ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਗੱਲ ਕਰ ਰਹੀ ਹਾਂ ਮੈਂ ਤੁਹਾਡੇ ਪੇਜ ਤੋਂ ਥੋੜ੍ਹੇ ਦਿਨ ਪਹਿਲੇ ਇੱਕ ਕਰੋਕਰੀ ਦਾ ਸੈੱਟ ਔਡਰ ਕੀਤਾ ਸੀਗਾ ਅਤੇ ਮੈਂ ਉਹਦੇ ਬਾਰੇ ਵਿੱਚ ਆਪਣੇ ਕੁਝ ਪੁਆਇੰਟ ਆਫ ਵਿਊ ਦੇਣਾ ਚਾਹੁੰਦੀ ਸੀਗੀ ਮੈਨੂੰ ਇਹ ਸੈੱਟ ਬਹੁਤ ਹੀ ਜ਼ਿਆਦਾ ਪਸੰਦ ਆਇਆ ਅਤੇ ਮੈਂ ਜਿਹਨੂੰ ਵੀ ਇਹ ਸੈੱਟ ਦਿਖਾਇਆ ਉਹਨਾਂ ਨੇ ਸਭ ਨੇ ਬਹੁਤ ਹੀ ਤਾਰੀਫ਼ ਕੀਤੀ ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਇਹ ਸੈੱਟ ਤੂੰ ਕਿੱਥੋਂ ਲਿੱਤਾ ਹੈ ਇਹ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਏ ਅਤੇ ਜਿਹੜੀ ਇਹਦੀ ਡਿਲੀਵਰੀ ਸੀਗੀ ਉਹ ਵੀ ਬਹੁਤ ਵਧੀਆ ਸੀਗੀ ਅਤੇ ਮੈਨੂੰ ਤੁਸੀਂ ਕਿਹਾ ਸੀਗਾ ਕਿ ਥਰਟੀ ਡੇਜ਼ ਵਿੱਚ ਤੁਸੀਂ ਮੈਨੂੰ ਇਹ ਡਿਲੀਵਰ ਕਰੂਂਗੇ ਬਟ ਇਹ ਮੈਨੂੰ ਤੀਹ ਦਿਨ ਦੀ ਬਜਾਏ ਪੰਦਰ੍ਹਾਂ ਦਿਨਾਂ ਦੇ ਵਿੱਚ ਹੀ ਮੈਨੂੰ ਇਹ ਸੈੱਟ ਜਿਹੜਾ ਹੈ ਔਡਰ ਜੋ ਹੈ ਮੈਨੂੰ ਡਿਲੀਵਰ ਹੋ ਗਿਆ ਅਤੇ ਇਹਦੀ ਜਿਹੜੀ ਪੈਕਿੰਗ ਹੈ ਉਹ ਬਹੁਤ ਹੀ ਵਧੀਆ ਹੈਗੀ ਹੈ ਮੈਂ ਬਹੁਤ ਹੀ ਸੈਟੀਸਫਾਈਡ ਹੈਗੀ ਹਾਂ ਅਤੇ ਜਿਹੜਾ ਮੈਂ ਕਲਰ ਚੂਜ਼ ਕੀਤਾ ਸੀਗਾ ਮੈਨੂੰ ਸੇਮ ਐਕਜੈਕਟ ਉਹ ਹੀ ਕਲਰ ਮਿਲਿਆ ਏ ਅਤੇ ਡਿਜ਼ਾਈਨ ਵੀ ਬਹੁਤ ਵਧੀਆ ਏ ਥਰੀ ਡੀ ਪੈਟਰਨ ਆ ਉਹਦੇ ਵਿੱਚ ਅਤੇ ਉਹਦੇ ਫਲਾਰਸ ਦਾ ਜਿਹੜਾ ਡਿਜ਼ਾਈਨ ਹੈ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਅਤੇ ਇਹਦੇ ਵਿੱਚ ਜਿੰਨੇ ਪੀਸ ਦਾ ਸੈੱਟ ਸੀਗਾ ਇਹ ਜਿੰਨਾਂ ਮੈਂ ਦੇਖਿਆ ਸੀਗਾ ਔਡਰ ਕਰਨ ਲੱਗੇ ਉਨਾਂ ਹੀ ਮਿਲਿਆ ਹੈ ਮੈਨੂੰ ਅਤੇ ਜਿਹੜਾ ਇਹਦਾ ਗਲਾਸਿਜ਼ ਦਾ ਜਿਹੜਾ ਡਿਜ਼ਾਈਨ ਹੈਗਾ ਬਹੁਤ ਹੀ ਯੂਨੀਕ ਹੈ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਅਤੇ ਜਿਹੜਾ ਵੀ ਕੋਈ ਮੇਰੇ ਘਰ ਆਉਂਦਾ ਹੈ ਅਤੇ ਮੈਂ ਜਦ ਉਹਨਾਂ ਨੂੰ ਗੈਸਟ ਨੂੰ ਉਸੀ ਕਰੌਕਰੀ ਸੈੱਟ ਦੇ ਵਿੱਚ ਡਿਨਰ ਵਗੈਰਾ ਸਰਵ ਕਰਦੀ ਹਾਂ ਅਤੇ ਉਹਨਾਂ ਨੂੰ ਉਹ ਸੈੱਟ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ ਅਤੇ ਜਿਹੜੀ ਤੁਸੀਂ ਮੈਨੂੰ ਇਹ ਦੇ ਉੱਤੇ ਥਰਟੀ ਪ੍ਰਸੈਂਟ ਦੀ ਛੂਟ ਦਿੱਤੀ ਸੀਗੀ ਅਤੇ ਉਹ ਵੀ ਬਹੁਤ ਵਧੀਆ ਲੱਗੀ ਮੈਨੂੰ ਕਿਉਂਕਿ ਇੰਨੇ ਘੱਟ ਰੇਟ ਦੇ ਵਿੱਚ ਮੈਨੂੰ ਹੋਰ ਕਿਤੇ ਵੀ ਇਹ ਕਰੌਕਰੀ ਸੈੱਟ ਨਹੀਂ ਮਿਲ ਸਕਦਾ ਸੀਗਾ ਅਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਅਤੇ ਮੈਂ ਅੱਗੇ ਤੋਂ ਵੀ ਆਪਣੀ ਜਿਹੜੀ ਸ਼ੋਪਿੰਗ ਹੈ ਉਹ ਤੁਹਾਡੇ ਪੇਜ਼ ਤੋਂ ਕੰਟੀਨਿਊ ਰੱਖਾਂਗੀ